ਜੇਕਰ ਪੁਰਾਣੇ ਸਮੇਂ ਦੇ ਨਾਲ ਅੱਜ ਦੇ ਸਮੇਂ ਨੂੰ ਕੰਪੇਅਰ ਕੀਤਾ ਜਾਵੇ ਤਾਂ ਪੰਜਾਬੀ ਸਾਡੀ ਪੰਜਾਬੀ ਮਾਂ ਬੋਲੀ ਦੇ ਵਿੱਚ ਕਾਫੀ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਨੇ ਪਹਿਲਾਂ ਜਿਹੜੀ ਪੰਜਾਬੀ ਬੋਲੀ ਜਾਂਦੀ ਸੀ ਜਾਂ ਪੜ੍ਹਾਈ ਜਾਂਦੀ ਸੀ ਉਹ ਠੇਠ ਪੰਜਾਬੀ ਹੁੰਦੀ ਸੀ ਜਿਹਦੇ ਵਿੱਚ ਕਿ ਪੰਜਾਬੀ ਦੇ ਠੇਠ ਸ਼ਬਦ ਹੁੰਦੇ ਸੀ ਬਿਲਕੁਲ ਜਿਹਨਾਂ ਨੂੰ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਸਮਝਣਾ ਬਹੁਤ ਔਖਾ ਹੈ ਤਾਂ ਇਸ ਸਹੂਲੀਅਤ ਨੂੰ ਦੇਖਦੇ ਹੋਏ ਬਦਲਦੇ ਜ਼ਮਾਨੇ ਨੂੰ ਦੇਖਦੇ ਹੋਏ ਤਬਦੀਲੀਆਂ ਨੂੰ ਦੇਖਦੇ ਹੋਏ ਇਹ ਪੰਜਾਬੀ ਭਾਸ਼ਾ ਦੇ ਵਿੱਚ ਸਾਡੀ ਪੰਜਾਬੀ ਮਾਂ ਬੋਲੀ ਦੇ ਵਿੱਚ ਕਈ ਤਰ੍ਹਾਂ ਦੇ ਦੀਆਂ ਤਬਦੀਲੀਆਂ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਅੱਜ ਕੱਲ੍ਹ ਜਿਹੜੀ ਪੰਜਾਬੀ ਮਾਂ ਬੋਲੀ ਬੋਲੀ ਜਾਂਦੀ ਹੈ ਜਾਂ ਸਿਖਾਈ ਜਾਂਦੀ ਹੈ ਉਹਦੇ ਵਿੱਚ ਪਹਿਲਾਂ ਜਿਹੜੀ ਸਿਖਾਈ ਜਾਂਦੀ ਸੀ ਉਹਦੇ ਨਾਲੋਂ ਬਹੁਤ ਜ਼ਿਆਦਾ ਫਰਕ ਨਜ਼ਰ ਆਉਂਦਾ ਹੈ ਕਈ ਜਿਹੜੇ ਪੰਜਾਬੀ ਦੇ ਠੇਠ ਸ਼ਬਦ ਹੁੰਦੇ ਸੀ ਉਹਨਾਂ ਨੂੰ ਆਪਣੇ ਤਰੀਕੇ ਨਾਲ ਬਦਲ ਕੇ ਤਬਦੀਲ ਕਰਕੇ ਹੋਰ ਤਰੀਕੇ ਨਾਲ ਉਹਨਾਂ ਨੂੰ ਬੋਲਿਆ ਜਾਣ ਲੱਗ ਪਿਆ ਹੈ ਆਪਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਨੂੰ ਪੰਜਾਬੀ ਮਾਂ ਬੋਲੀ ਨੂੰ ਵਿਕਸਿਤ ਕੀਤਾ ਗਿਆ ਹੈ ਨਵੇਂ ਰੂਪ ਦੇ ਵਿੱਚ ਉਭਾਰ ਕੇ ਲਿਆਉਂਦਾ ਗਿਆ ਹੈ ਤਾਂ ਕਿ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਹੈ ਅੱਜ ਕੱਲ੍ਹ ਦੇ ਬੱਚੇ ਹੈ ਉਹ ਉਸ ਸਾਡੀ ਮਾਂ ਬੋਲੀ ਨੂੰ ਪੰਜਾਬੀ ਭਾਸ਼ਾ ਨੂੰ ਸਿੱਖ ਸਕਣ ਆਸਾਨੀ ਦੇ ਨਾਲ ਬੋਲ ਸਕਣ ਜਿਹੜੇ ਸਿੱਖਣਾ ਚਾਹੁੰਦੇ ਹਨ ਉਹ ਸਿੱਖ ਵੀ ਸਕਣ ਤਬਦੀਲੀਆਂ ਇਹੀ ਤਬਦੀਲੀਆਂ ਨੇ ਜਿਹੜੀਆਂ ਕਿ ਪਹਿਲਾਂ ਦੇ ਨਾਲੋਂ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਇਹ ਦੇਖਣ ਨੂੰ ਮਿਲ ਸਕਦੀਆਂ ਨੇ ਕਿ ਪੰਜਾਬੀ ਮਾਂ ਬੋਲੀ ਦੇ ਜਿਹੜੇ ਸ਼ਬਦ ਹੁੰਦੇ ਸੀ ਪਹਿਲਾਂ ਪੁਰਾਣੇ ਸ਼ਬਦ ਹੁੰਦੇ ਸੀ ਉਹਨਾਂ ਨੂੰ ਬਦਲ ਕੇ ਨਵੇਂ ਤਰੀਕੇ ਦੇ ਨਾਲ ਨਵੇਂ ਢੰਗ ਦੇ ਨਾਲ ਹੁਣ ਪੜ੍ਹਾਇਆ ਵੀ ਜਾਂਦਾ ਹੈ ਸਿਖਾਇਆ ਵੀ ਜਾਂਦਾ ਹੈ ਅਤੇ ਬੋਲਿਆ ਵੀ ਜਾਂਦਾ ਹੈ